ਹਾਂ ਮੈਂ ਭੰਗੜਾ ਐਥਲੈਟਿਕ ਅਤੇ ਡਾਂਸ ਅਧਾਰਿਤ ਵਰਕਆਊਟ ਦੇ ਲਾਭਾਂ ਤੋਂ ਪੂਰੀ ਤਰ੍ਹਾਂ ਵਾਕਫ ਹਾਂ ਭੰਗੜਾ ਕੇਵਲ ਇੱਕ ਰਵਾਇਤੀ ਨਾਚ ਹੀ ਨਹੀਂ ਬਲਕਿ ਇਹ ਇਕ ਉਤਸਾਹ ਪੂਰਨ ਐਕਸਰਸਾਈਜ਼ ਵੀ ਹੈ ਜੋ ਸਰੀਰਕ ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਵਿੱਚ ਵਿਸ਼ੇਸ਼ ਯੋਗਦਾਨ ਪਾਉਂਦੀ ਹੈ ਇਹ ਇੱਕ ਐਰੋਬਿਕ ਐਕਸਰਸਾਈਜ਼ ਦਾ ਤਰੀਕਾ ਹੈ ਜਿਸ ਵਿੱਚ ਉੱਚ ਤੀਵਰਤਾ ਵਾਲੀਆਂ ਕਸਰਤਾਂ ਜਿਵੇਂ ਕਿ ਉੱਚੇ ਕੂਦ ਘੁਟਨਿਆਂ ਨੂੰ ਉੱਚਾ ਕਰਦੇ ਨੱਚਣਾ ਤੇਜ਼ ਹਲਚਲ ਅਤੇ ਸਰੀਰ ਦੇ ਹਰ ਹਿੱਸੇ ਦੀ ਗਤੀਸ਼ੀਲਤਾ ਸ਼ਾਮਿਲ ਹੁੰਦੀ ਹੈ ਭੰਗੜਾ ਐਥਲੈਟਿਕ ਦੇ ਸਰੀਰਕ ਲਾਭ ਦਿਲ ਦੀ ਤੰਦਰੁਸਤੀ ਭੰਗੜਾ ਐਥਲੈਟਿਕਸ ਦਿਲ ਦੀ ਗਤੀਵਿਧੀ ਨੂੰ ਵਧਾਉਂਦਾ ਹੈ ਰਕਤ ਪ੍ਰਬੰਧਨ ਨੂੰ ਸੁਧਾਰਦਾ ਹੈ ਅਤੇ ਹਿਰਦੇ ਰੋਗਾ ਦੇ ਖਤਰੇ ਨੂੰ ਘਟਾਉਂਦਾ ਹੈ ਇਹ ਦਿਲ ਦੇ ਫੇਫੜੇ ਦੀ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਕਿਉਂਕਿ ਇਸ ਦੌਰਾਨ ਸਰੀਰ ਨੂੰ ਵਧੇਰੇ ਆਕਸੀਜਨ ਦੀ ਲੋੜ ਹੁੰਦੀ ਹੈ ਕੈਲੋਰੀ ਵਰਨ ਕਰਨ ਵਿੱਚ ਵਜ਼ਨ ਘਟਾਉਣਾ ਭੰਗੜਾ ਇੱਕ ਉੱਚ ਤੀਵਰਤਾ ਵਾਲੀ ਐਕਸਰਸਾਈਜ਼ ਹੈ ਜੋ ਕਿ ਤੀਹ ਪੰਤਾਲੀ ਮਿੰਟ ਦੇ ਇੱਕ ਸੈਸ਼ਨ ਵਿੱਚ ਪੰਜ ਸੌ ਅੱਠ ਸੌ ਕੈਲੋਰੀ ਜਲਾਉਣ ਵਿੱਚ ਮਦਦ ਕਰ ਸਕਦੀ ਹੈ ਇਹ ਵਧੇਰੇ ਚਰਬੀ ਘਟਾਉਣ ਅਤੇ ਵਜ਼ਨ ਕੰਟਰੋਲ ਕਰਨ ਵਿੱਚ ਬਹੁਤ ਲਾਭਕਾਰੀ ਹੈ ਮਾਸਪੇਸ਼ੀਆਂ ਦੀ ਮਜ਼ਬੂਤੀ ਅਤੇ ਲਚਕਤਾ ਭੰਗੜਾ ਕਰਦੇ ਹੋਏ ਪੈਰਾਂ ਹੱਥਾਂ ਪਿੱਠ ਅਤੇ ਕੋਰ ਮਾਸਪੇਸ਼ੀਆਂ ਦੀ ਮਜ਼ਬੂਤੀ ਵੱਧਦੀ ਹੈ ਇਹ ਸਰੀਰ ਦੀ ਸੰਤੁਲਨ ਸ਼ਕਤੀ ਬੈਲੈਂਸ ਨੂੰ ਵਧਾਉਣ ਵਧਾਉਂਦਾ ਹੈ ਅਤੇ ਸਰੀਰ ਨੂੰ ਹੋਰ ਲਚਕਤਾ ਦਿੰਦਾ ਹੈ ਹੱਡੀਆਂ ਦੀ ਤਾਕਤ ਅਤੇ ਜੋੜਾਂ ਦੀ ਤੰਦਰੁਸਤੀ ਲੰਬੇ ਸਮੇਂ ਤੱਕ ਵਰਕਆਊਟ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਜੋੜਾਂ ਦੀ ਚਮੜੀ ਲਚਕਦਾਰ ਬਣਦੀ ਹੈ ਭੰਗੜਾ ਐਥਲੈਟਿਕ ਆਸਟੀਓਪਰੋਸੀਜ ਅਤੇ ਜੋੜਾਂ ਦੀ ਸ਼ਕਤੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਮਾਨਸਿਕ ਅਤੇ ਭਾਵਨਾਤਮਕ ਖਿਲਾਫ ਤਨਾਅ ਅਤੇ ਚਿੰਤਾ ਘਟਾਉਂਦਾ ਭੰਗੜਾ ਐਥਲੈਟਿਕ ਦੌਰਾਨ ਸਰੀਰ ਵਿੱਚ ਐਂਡੋਰੀਫਿਨ ਨਿਕਲਦੇ ਹਨ ਜੋ ਕਿ ਖੁਸ਼ੀ ਦੇ ਹਾਰਮੋਨ ਮੰਨੇ ਜਾਂਦੇ ਹਨ ਇਹ ਤਨਾਅ ਚਿੰਤਾ ਅਤੇ ਉਦਾਸੀ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ ਸੈਲਫ ਕੌਨਫੀਡੈਂਸ ਅਤੇ ਆਤਮ ਵਿਸ਼ਵਾਸ ਵਧਾਉਣਾ ਨੱਚਣਾ ਅਤੇ ਭੰਗੜਾ ਕਰਨਾ ਇੱਕ ਧਾਰਮਿਕ ਅਤੇ ਸਭਿਆਚਾਰਕ ਤਰੀਕਾ ਵੀ ਹੈ ਜੋ ਕਿ ਆਤਮ ਵਿਸ਼ਵਾਸ ਵਧਾਉਂਦਾ ਹੈ ਇਹ ਵਿਅਕਤੀ ਦੇ ਮਨ ਦੀ ਸ਼ਾਂਤੀ ਲਈ ਵੀ ਬਹੁਤ ਲਾਭਕਾਰੀ ਹੈ ਸਮਾਜਿਕ ਸੰਬੰਧ ਮਜ਼ਬੂਤ ਕਰਨਾ ਭੰਗੜਾ ਸਮੂਹ ਵਿੱਚ ਕੀਤਾ ਜਾਂਦਾ ਹੈ ਜੋ ਕਿ ਲੋਕ ਲੋਕਾਂ ਵਿਚਾਰ ਵਿਚਕਾਰ ਇਕੱਠੇ ਬੈਠਣ ਗੱਲਬਾਤ ਕਰਨ ਅਤੇ ਸਮਾਜਿਕ ਤਰੀਕੇ ਨਾਲ ਜੁੜਨ ਦਾ ਮੌਕਾ ਦਿੰਦਾ ਹੈ ਇਹ ਸਮਾਜਿਕ ਤਨਾਅ ਘਟਾਉਂਦਾ ਹੈ ਅਤੇ ਲੋਕਾਂ ਨੂੰ ਹੋਰ ਚੁਸਤ ਅਤੇ ਉਤਸਾਹਿਤ ਮਹਿਸੂਸ ਕਰਾਉਂਦਾ ਹੈ